ਭਾਰਤੀ ਸਿਹਤ ਪ੍ਰਣਾਲੀ ਬਹੁਤ ਵਧੀਆ ਹੈ ਪਰ ਪੰਜਾਬ ਵਿੱਚ ਸਾਨੂੰ ਕਿਸੇ ਕਈ ਕਈ ਤਰ੍ਹਾਂ ਦੇ ਮਸਾਲਿਆਂ ਦਾ ਖਾਣੇ ਪੈਂਦੇ ਹਨ ਤਾਂ ਜੇ ਤਾਂ ਜੋ ਇਹ ਅਸੀਂ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹਨ ਸਾਨੂੰ ਮਸਾਲੇ ਸਾਨੂੰ ਹੋਰ ਵੀ ਮਸਾਲੇ ਬਹੁਤ ਘੱਟ ਖਾਣੇ ਚਾਹੀਦੇ ਹਨ ਕਿਉਂਕਿ ਇਹ ਸਾਡੀ ਸਿਹਤ ਨੂੰ ਨੁਕਸਾਨ ਕਰਦੇ ਹਨ ਇਸ ਨਾਲ ਕਈ ਬਤ ਕਈ ਬਜ਼ੁਰਗਾਂ ਬੱਚਿਆਂ ਦੀ ਜ਼ਿਆਦਾ ਮਸਾਲੇ ਕਾਰਣ ਖਾਣ ਵੀ ਮੌਤ ਹੋ ਜਾਂਦੀ ਹੈ ਕਈਆਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਪਰ ਪਰ ਭਾਰਤੀ ਸਿਹਤ ਪ੍ਰਣਾਲੀ ਬ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਬ ਹੈਲਥੀ ਖਾਣਾ ਸਾਨੂੰ ਹਮੇਸ਼ਾ ਹੈਲਥੀ ਖਾਣਾ ਖਾਣਾ ਚਾਹੀਦਾ ਹੈ ਅਤੇ ਇਸ ਨਾਲ ਸਾਡੀ ਜੇ ਆਪਾਂ ਹੋਰ ਵੀ ਪੰਜਾਬ ਦਾ ਖਾਣਾ ਖ਼ਾਸ ਆ ਪੰਜਾਬ ਦਾ ਖਾਣਾ ਬਹੁਤ ਸਿਹਤ ਲਈ ਵਧੀਆ ਹੁੰਦਾ ਹੈ ਇਸ ਇਹ ਖਾਣਾ ਸਾਡੀ ਸਿਹਤ ਨੂੰ ਹ ਸਭ ਤੋਂ ਸਭ ਸਾਡੀ ਸਿਹਤ ਲਈ ਤੰਦਰੁਸਤ ਹੁੰਦਾ ਹੈ ਅਤੇ ਸਾਡੇ ਲਈ ਪਚਨ ਦਾਇਕ ਹੁੰਦਾ ਹੈ ਇਹ ਸਾਨੂੰ ਕੋਈ ਵੀ ਬਿਮਾਰੀ ਲੱਗਣ ਨਹੀਂ ਦਿੰਦੀਆਂ ਅਤੇ ਜੇ ਆਪਾਂ ਬਾਹਰ ਜੇ ਆਪਾਂ ਬਾਹਰਲਾ ਕੁਛ ਖਾਣਾ ਖਾਂਦੇ ਹਾਂ ਅਤੇ ਉਹ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ ਹੈ ਉਸ ਵਿੱਚ ਮਸਾਲੇ ਬਹੁਤ ਪਾਏ ਜਾਂਦੇ ਹਨ ਅਤੇ ਇਹ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨਦਾਇਕ ਕਰਦੀਆਂ ਹਨ ਅਤੇ ਸਾਨੂੰ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਰਤੀ ਸਿਹਤ ਪ੍ਰਣਾਲੀ ਹੈ ਬਹੁਤ ਵਧੀਆ ਹੈ ਅਤੇ ਇਸ ਦਾ ਸਾਹਮਣਾ ਕਰਨ ਲਈ ਸਾਨੂੰ ਹੋਰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜੋ ਅਗਲੀ ਪੀੜ੍ਹੀ ਆਉਣ ਵਾਲੀ ਪੀੜ੍ਹੀ ਨੂੰ ਸਾਨੂੰ ਮਸਾਲੇ ਜ਼ਿਆਦਾ ਮਸਾਲੇ ਨਾ ਖਾਣੇ ਪੈਣ ਅਤੇ ਕਈ ਜ਼ਿਆਦਾ ਮਸਾਲੇ ਖਾਣ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ